ਸਤਿ ਸ਼੍ਰੀ ਅਕਾਲ ਮੈਂ ਗਗਨਪ੍ਰੀਤ ਕੌਰ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਜਿਵੇਂ ਕਿ ਆਪਣੇ ਖੇਤਰ ਦੇ ਥੋੜ੍ਹੇ ਕਾਰੋਬਾਰ ਬਾਰੇ ਮੈਂ ਤੁਹਾਨੂੰ ਜਾਣੂ ਕਰਾਨੀ ਹਾਂ ਕੁਦਰਤੀ ਸਰੋਤ ਬਾਰੇ ਅਤੇ ਇੱਥੇ ਮਤਲਬ ਕਿ ਲੋਕਾਂ ਨੇ ਲੋਕ ਜਿਹੜੇ ਹੈ ਵਾ ਆਪਣੇ ਕਾਰੋਬਾਰ ਲਈ ਆਪਣੇ ਘਰ ਗਾਂਈ ਅਤੇ ਮੱਝਾਂ ਰੱਖੀਆਂ ਹਨ ਅਤੇ ਉਹਨਾਂ ਨੇ ਤਬੇਲੇ ਪਾਏ ਹੋਏ ਹਨ ਅਤੇ ਉਹ ਗਾਂਈ ਮੱਝਾਂ ਦੇ ਤਬੇਲੇ ਪਾ ਕੇ ਉਹ ਉਹਨਾਂ ਤੋਂ ਦੁੱਧ ਦੁੱਧ ਵਗੈਰਾ ਲੈਂਦੇ ਹਨ ਅਤੇ ਉਹ ਗਾਈਆਂ ਮੱਝਾਂ ਦੁੱਧ ਦਿੰਦੀਆਂ ਹਨ ਅਤੇ ਉਹ ਦੁੱਧ ਵਗੈਰਾ ਲੈ ਕੇ ਅਤੇ ਉਹਨਾਂ ਦਾ ਕੁਛ ਲੋਕ ਉਹਦਾ ਦਹੀਂ ਬਣਾਉਂਦੇ ਹਨ ਅਤੇ ਪਨੀਰ ਪਨੀਰ ਵਗੈਰਾ ਬਣਦਾ ਏ ਅਤੇ ਉਹ ਸਾਰੀ ਚੀਜ਼ ਯੂਜ ਕਰਕੇ ਕਰੀਮਾਂ ਵਗੈਰਾ ਵੀ ਦੁੱਧ ਦੀਆਂ ਬਣਦੀਆਂ ਹਨ ਅਤੇ ਉਹ ਦੁੱਧ ਨੂੰ ਯੂਜ ਕਰਕੇ ਅਤੇ ਉਹ ਉਹਨਾਂ ਨੂੰ ਵੇਚਦੇ ਹਨ ਆਪਣੇ ਵਪਾਰ ਦੇ ਵਿੱਚ ਵਰਤਦੇ ਹਨ ਅਤੇ ਇਹੀ ਦੁੱਧ ਦਹੀਂ ਪਨੀਰ ਵਗੈਰਾ ਸਾਰਾ ਅੱਗੇ ਸਪਲਾਈ ਹੁੰਦਾ ਹੈ ਅਤੇ ਅੱਗੇ ਸਪਲਾਈ ਹੋ ਜਾਂਦਾ ਹੈ ਅਤੇ ਮਤਲਬ ਕਿ ਜਿੱਦਾਂ ਲਾਗੇ ਸਾਡੇ ਕੁਦਰਤੀ ਸਰੋਤ ਵਿੱਚ ਪੇੜ ਪੌਦੇ ਵੀ ਲਗਾਏ ਜਾਂਦੇ ਹਨ ਅਤੇ ਪੇੜਾਂ ਵਿੱਚੋਂ ਮਤਲਬ ਕੁਝ ਪੇੜ ਵਗੈਰਾ ਲਗਾ ਕੇ ਉਹਨਾਂ ਦੀ ਲੱਕੜ ਕੱਟ ਕੇ ਅਤੇ ਉਹ ਉਹਨਾਂ ਦਾ ਲੱਕੜ ਕੱਟ ਕੇ ਅਤੇ ਉਹਨਾਂ ਦਾ ਫਰਨੀਚਰ ਵਗੈਰਾ ਤਿਆਰ ਹੁੰਦਾ ਏ ਅਤੇ ਉਹਨੂੰ ਵੀ ਮਤਲਬ ਕਿ ਜਾਂ ਬੈਡ ਵਗੈਰਾ ਫਰਨੀਚਰ ਵਿੱਚ ਪਾਉਂਦੇ ਟੇਬਲ ਅਤੇ ਅਲਮਾਰੀਆਂ ਲੱਕੜ ਦੀਆਂ ਇਹ ਸਾਰਾ ਯੂਜ ਕਰਕੇ ਅਤੇ ਇਹਨੂੰ ਅੱਗੇ ਆਪਣੀ ਵਪਾਰਕ ਵਿੱਚ ਯੂਜ ਵਪਾਰਕ ਖੇ ਵਾ ਵਪਾਰਕ ਕੰਮਾਂ ਵਿੱਚ ਵੀ ਉਹਦਾ ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਪੈਸੇ ਵਗੈਰਾ ਉਹਨਾਂ ਦਾ ਮਤਲਬ ਕਿ ਵਰਤੇ ਜਾਂਦੇ ਅਤੇ ਆਹੀ ਜਿਹੜੇ ਫਰਨੀਚਰ ਵਗੈਰਾ ਅਤੇ ਸਮਾਨ ਬਣਿਆ ਹੁੰਦਾ ਇਹੀ ਅੱਗੇ ਅੱਗੇ ਸਪਲਾਈ ਹੁੰਦਾ ਜਾਂਦਾ ਏ